ਵੈਸੇ ਜ਼ਿਆਦਾ ਬੱਚਿਆਂ ਨੂੰ ਇਦਾਂ ਦੀ ਪ੍ਰੋਬਲਮ ਤੇ ਨਹੀਂ ਆਉਂਦੀ ਪਰ ਕਈ ਸਾਰੇ ਬੱਚਿਆਂ ਨੂੰ ਇੱਦਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਬੱਚੇ ਅਪਾਹਿਜ ਆ ਜਾਂ ਅੰਨੇ ਬੋਲੇ ਆ ਉਹਨਾਂ ਲਈ ਸਰਕਾਰ ਵੀ ਕਾਫੀ ਕੁਝ ਕਰ ਰਹੀ ਹੈ ਜਿਵੇਂ ਕਿ ਉਹਨਾਂ ਨੂੰ ਪੈਨਸ਼ਨ ਵਗੈਰਾ ਵੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਮੰਥਲੀ ਜਿਹੜਾ ਖਰਚਾ ਉਹ ਆਰਾਮ ਨਾਲ ਕਰ ਸਕਣ ਇਹਨਾਂ ਇਹਨਾਂ ਲਈ ਕਈ ਸਾਰੇ ਸਕੂਲ ਵੀ ਬਣਾਏ ਗਏ ਆ ਜਿਵੇਂ ਕਿ ਸਾਡੇ ਆਸ ਪਾਸ ਹੀ ਸਕੂਲ ਹੈ ਆਸਾ ਸਕੂਲ ਨੀਅਰ ਆਰਮੀ ਪਬਲਿਕ ਸਕੂਲ ਸੁਜਾਨਪੁਰ ਪਠਾਨਕੋਟ ਵਿੱਚ ਹੈ ਜਿੱਥੇ ਕਿ ਜਿਹੜੇ ਇੱਦਾਂ ਦੇ ਬੱਚੇ ਆ ਉਹ ਐਡਮਿਸ਼ਨ ਲੈ ਸਕਦੇ ਆ ਅਤੇ ਐਜੂਕੇਟ ਹੋ ਸਕਦੇ ਆ ਆਪਣੀ ਪੜ੍ਹਾਈ ਜਿਹੜੀ ਆ ਉਹ ਕੰਟੀਨਿਊ ਕਰ ਸਕਦੇ ਆ ਅਜਿਹੇ ਬੱਚਿਆਂ ਲਈ ਹੋਰ ਵੀ ਕਈ ਸਾਰੀਆਂ ਜਿਹੜੀਆਂ ਸਕੀਮਾਂ ਉਹ ਸਰਕਾਰ ਦੁਆਰਾ ਚਲਾਈਆਂ ਗਈਆਂ ਹਨ ਸਾਨੂੰ ਚਾਹੀਦਾ ਹੈ ਕਿ ਅਜਿਹੇ ਬੱਚਿਆਂ ਨਾਲ ਜ਼ਿਆਦਾ ਪਾਰਸ਼ੈਲਿਟੀ ਨਹੀਂ ਕਰਨੀ ਚਾਹੀਦੀ ਕਈ ਸਾਰੇ ਬੱਚੇ ਇਹਨਾਂ ਬੱਚਿਆਂ ਨੂੰ ਦੇਖ ਕੇ ਹੱਸਦੇ ਆ ਉਹ ਸਭ ਨਹੀਂ ਕਰਨਾ ਚਾਹੀਦਾ ਹੂੰ ਹੂੰ ਕਈ ਕਈ ਵਾਰ ਇਹਨਾਂ ਬੱਚਿਆਂ ਨੂੰ ਕਈ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਹ ਪੇਰੈਂਟਸ ਜ਼ਿਆਦਾ ਅਫੋਰਡ ਨਹੀਂ ਕਰ ਪਾਉਂਦੇ ਜ਼ਿਆਦਾ ਪੈਸੇ ਹੋਣ ਦੀ ਨਹੀਂ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਪੜ੍ਹਾ ਨਹੀਂ ਪਾਉਂਦੇ ਅਤੇ ਅਜਿਹੇ ਬੱਚਿਆਂ ਨੂੰ ਸਾਨੂੰ ਚਾਹੀਦਾ ਹੈ ਕਿ ਜੇ ਸਾਨੂੰ ਕਿਤੇ ਵੀ ਅਜਿਹੇ ਬੱਚੇ ਮਿਲਣ ਤਾਂ ਜਿੰਨਾ ਹੋ ਸਕਦਾ ਉਹਨਾਂ ਦੀ ਜਿ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਆ ਧੰਨਵਾਦ